ਇਹ ਕਰੋਕਰੀ ਥੋੜ੍ਹੀ ਜੀ ਭਾਰੀ ਹੈ ਭਾਰੀ ਹੈ ਅਤੇ ਇਸ ਨੂੰ ਚੱਕਣ ਵੇਲੇ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਜਦੋਂ ਅਸੀਂ ਭੋਜਨ ਪਰੋਸ ਕੇ ਉਸ ਕੇ ਇਸ ਨੂੰ ਸਾਫ ਕਰਨ ਜਾਂਦੇ ਹਾਂ ਅਤੇ ਇਸ ਦੇ ਉੱਤੇ ਲੱਗੀ ਹੋਈ ਗੰਦਗੀ ਜਲਦੀ ਸਾਫ ਨਹੀਂ ਹੁੰਦੀ ਇਸ ਨੂੰ ਬਹੁਤ ਵਾਰ ਧੋਣਾ ਪੈਂਦਾ ਹੈ